ਮੈਂ ਮਾਨਵ ਪਠਾਣੀਆ ਪਠਾਨਕੋਟ ਦਾ ਰਹਿਣ ਵਾਲਾ ਹਾਂ ਪੰਜ ਤਰੀਕਾਂ ਜੋ ਕਿ ਮੈਨੂੰ ਯਾਦ ਹਨ ਉਹ ਇਸ ਤਰ੍ਹਾਂ ਹੈ ਪਹਿਲੀ ਗਿਆਰਾਂ ਜੁਲਾਈ ਦੋ ਹਜ਼ਾਰ ਪੰਜ ਦੂਜੀ ਬਾਰ੍ਹਾਂ ਫਰਵਰੀ ਦੋ ਹਜ਼ਾਰ ਅੱਠ ਤੀਜੀ ਅੱਠ ਜੁਲਾਈ ਦੋ ਹਜ਼ਾਰ ਦਸ ਚੌਥੀ ਨੌਂ ਫਰਵਰੀ ਦੋ ਹਜ਼ਾਰ ਚੌਵੀ ਅਤੇ ਆਖਰੀ ਜਿਹੜੀ ਕਿ ਪੰਜਵੀਂ ਹੈ ਉਹ ਹੈ ਛੇ ਅਕਤੂਬਰ ਦੋ ਹਜ਼ਾਰ ਪੰਦਰਾਂ